ਹਾਂਜੀ ਜੀ ਕਿੱਥੋਂ ਬੋਲਦੇ ਪਏ ਜੀ ਹਾਂਜੀ ਮੈਂ ਲੋਕਲ ਹੀ ਆ ਇੱਥੋਂ ਦੀ ਹਾਂਜੀ ਦੱਸੋ ਇੱਥੇ ਤਾਂ ਸਾਰੀ ਵਧੀਆ ਨੇ ਜਿਵੇਂ ਮੋਡਰਨ ਸਟੂਡੈਂਟ ਵੀ ਵਧੀਆ ਇਥੇ ਹੰਗਰੀ ਪੁਆਇੰਟ ਵੀ ਵਧੀਆ ਰੈਸਟੋਰੈਂਟ ਵੀ ਵਧੀਆ ਹਾਂਜੀ ਇਹਨਾਂ ਦਾ ਖਾਣਾ ਬਹੁਤ ਵਧੀਆ ਆ ਅਸੀਂ ਸਾਰੇ ਵੈਜੀਟੇਰੀਅਨ ਹੀ ਹਾਂ ਸਾਰੇ ਵਧੀਆ ਰੈਸਟੋਰੈਂਟ ਆ ਅਸੀਂ ਆਪ ਵੀ ਜਾਂਦੇ ਵਿਕਟੋਰੀਆ ਰੈਸਟੋਰੈਂਟ ਜਿਹੜਾ ਉਹ ਜ਼ਿਆਦਾ ਵਧੀਆ

ਖਰਚਾ ਠੀਕ ਹੈ ਠੀਕ ਠਾਕ ਇੱਥੇ ਇੰਨਾ ਜ਼ਿਆਦਾ ਖਰਚਾ ਵੀ ਨਹੀਂ ਹੋਈ ਜਾਂਦਾ ਮਤਲਬ ਦੋ ਹਜ਼ਾਰ ਤੱਕ ਠੀਕ ਹੋ ਜਾਂਦਾ ਰੂਮ ਦਾ ਵੀ ਅਗਰ ਰੂਮ ਇਕ ਦਿਨ ਲਈ ਰਹਿਣਾ ਪੰਜ ਕੁ ਹਜ਼ਾਰ ਹੋ ਜਾਂਦਾ ਹਾਂਜੀ ਘੁੰਮਣ ਵਾਲੀਆਂ ਜਗ੍ਹਾ ਵੀ ਬਹੁਤ ਜ਼ਿਆਦਾ ਇੱਥੇ ਪਾਰਕ ਵੀ ਇੱਥੇ ਬਹੁਤ ਜ਼ਿਆਦਾ ਹੈ ਅਤੇ ਮੀਨਜ਼ ਜਿੱਥੇ ਵੀ ਜਾਣਾ ਚਾਹੋਗੇ ਬਹੁਤ ਵਧੀਆ ਏਰੀਆ ਇੱਥੇ ਹਾਂਜੀ ਨਹੀਂ ਨਹੀਂ ਹਾਂਜੀ

ਹਾਂਜੀ ਹਾਂਜੀ ਬਿਲਕੁਲ ਹਾਂਜੀ ਜ਼ਰੂਰ ਮੈਂ ਤੁਹਾਨੂੰ ਵਟਸਐਪ 'ਤੇ ਮੈਸੇਜ ਕਰ ਦਿਆਂਗੀ ਉਹਨਾਂ ਦਾ ਨੰਬਰ ਹਾਂਜੀ ਠੀਕ